ਬਾਹਰੀ ਗਤੀਵਿਧੀਆਂ ਦੇ ਵਿੱਚ ਮੈਨੂੰ ਤੈਰਾਕੀ ਅਤੇ ਯੋਗਾ ਆਦਿ ਕਰਨ 'ਤੇ ਮੈਨੂੰ ਬਹੁਤ ਹੀ ਮਜ਼ਾ ਆਉਂਦਾ ਹੈ ਕਿਉਂਕਿ ਯੋਗਾ ਦੇ ਵਿੱਚ ਇੱਕ ਐਕਸੋਸਾ ਸਰੀਰ ਦੇ ਹਰ ਜੋੜ ਦੀ ਐਕਸੋਸਾਈਜ਼ ਹੁੰਦੀ ਹੈ ਅਤੇ ਨਾਲ ਨਾਲ ਹੀ ਯੋਗਾ ਦੇ ਵਿੱਚ ਮੈਡੀਟੇਸ਼ਨ ਦੇ ਨਾਲ ਮਾਨਸਿਕ ਸਰੀਰਿਕ ਦੇ ਨਾਲ ਨਾਲ ਮਾਨਸਿਕ ਵੀ ਤੰਦਰੁਸਤੀ ਮਿਲਦੀ ਹੈ ਅਤੇ ਨਾਲ ਹੀ ਇਸ ਨੂੰ ਆਪਾਂ ਯੋਗਾ ਨੂੰ ਜੇ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਕਰਦੇ ਹਾਂ ਅਤੇ ਸਾਡੇ ਕੋਲ ਨੇੜੇ ਕੋਈ ਬਿਮਾਰੀ ਨਹੀਂ ਆਉਂਦੀ ਅਤੇ ਨਾਲ ਹੀ ਸਾਡੇ ਸਰੀਰ ਦੇ ਵਿੱਚ ਸਫੂਰਤੀ ਰਹਿੰਦੀ ਹੈ ਅਤੇ ਇਸੇ ਤਰ੍ਹਾਂ ਹੀ ਤੈਰਾਕੀ ਨਾਲ ਵੀ ਸਾਡੇ ਬੌਡੀ ਸਾਡੇ ਸਰੀਰ ਦਾ ਹਰ ਇਕ ਅੰਗ ਦੀ ਵਰਜਿਸ਼ ਹੁੰਦੀ ਹੈ ਜਿਸ ਨਾਲ ਕਿ ਇੱਕ ਤਾਂ ਸਾਡਾ ਇੱਕ ਹੋਬੀ ਹੋਬੀ ਦੀ ਤਰ੍ਹਾਂ ਇੱਕ ਰੁਚੀ ਦੀ ਤਰ੍ਹਾਂ ਵੀ ਆਪਾਂ ਇਹ ਗਤੀਵਿਧੀ ਕਰ ਸਕਦੇ ਹਾਂ ਅਤੇ ਨਾਲ ਹੀ ਇਸ ਦੇ ਨਾਲ ਇੱਕ ਸਾਡੇ ਸਰੀਰ ਦੇ ਵਿੱਚ ਵੀ ਲਚਕ ਰਹਿੰਦੀ ਹੈ